ਪਾਣੀ ਦੀ ਲੋੜ ਦਿਨ ਦੇ ਦੌਰਾਨ ਕਈ ਕਾਰਨਾਂ ਕਰਕੇ ਵੱਖ ਵੱਖ ਹੋ ਸਕਦੀ ਹੈ ਸਭ ਤੋਂ ਪਹਿਲਾਂ ਸਰੀਰ ਦੇ ਹਾਈਡਰੇਸ਼ਨ ਨੂੰ ਬਰਕਰਾਰ ਰੱਖਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਵੱਖ ਵੱਖ ਚੀਜ਼ਾਂ ਕਰਦੇ ਹਾਂ ਜਿਵੇਂ ਕਿ ਕੰਮ ਕਰਨਾ ਐਕਸਰਸਾਈਜ਼ ਕਰਨਾ ਜਾਂ ਧੁੱਪ 'ਚ ਹੋਣਾ ਤਾਂ ਸਾਡੇ ਸਰੀਰ ਤੋਂ ਪਸੀਨਾ ਨਿਕਲਦਾ ਹੈ ਜਿਸ ਕਰਕੇ ਸਾਨੂੰ ਵਧੇਰੇ ਪਾਣੀ ਪੀਣ ਦੀ ਲੋੜ ਹੈ ਇਸ ਤੋਂ ਇਲਾਵਾ ਮੌਸਮ ਵੀ ਪਾਣੀ ਦੀ ਲੋੜ 'ਤੇ ਪ੍ਰਭਾਵ ਪਾਉਂਦਾ ਹੈ ਗਰਮੀਆਂ ਵਿੱਚ ਸਾਨੂੰ ਠੰ ਠੰਡੀ ਨਾਲੋਂ ਜ਼ਿਆਦਾ ਪਾਣੀ ਪੀਣ ਦੀ ਲੋੜ ਪੈਂਦੀ ਹੈ ਕਿਉਂਕਿ ਜ਼ਿਆਦਾ ਪਸੀਨਾ ਨਿਕਲਦਾ ਹੈ ਭੋਜਨ ਦੀ ਕਿਸਮ ਵੀ ਇਹਤੇ ਇਫੈਕਟ ਪੈਂਦੀ ਹੈ ਜੇਕਰ ਅਸੀਂ ਨਮਕੀਨ ਜਾਂ ਮਸਾਲੇਦਾਰ ਖਾਣਾ ਖਾਂਦੇ ਹਾਂ ਤਾਂ ਸਾਡੀ ਅਤੇ ਇਹ ਵੱਧ ਜਾਂਦੀ ਹੈ ਅਤੇ ਸਾਨੂੰ ਹੋਰ ਪਾਣੀ ਦੀ ਪਿਆਸ ਲੱਗਦੀ ਹੈ ਇਸ ਦਾ ਨਿਚੋੜ ਕੱਢਦੇ ਹੋਏ ਮੈਂ ਕਹਿਣਾ ਚਾਹਾਂ ਕਿਆ ਕਿ ਸਿਹਤ ਸੰਬੰਧੀ ਕਾਰਨ ਜਿਵੇਂ ਕਿ ਡੀਹਾਈਡਰੇਸ਼ਨ ਸਾਨੂੰ ਹੋ ਜਾਵੇ ਬੁਖਾਰ ਹੋ ਜਾਵੇ ਜਾਂ ਕੋਈ ਹੋਰ ਬਿਮਾਰੀ ਹੋ ਜਾਵੇ ਜਿਸ ਵਿੱਚ ਪਾਣੀ ਪੀਣ ਦੀ ਸਾਨੂੰ ਜ਼ਿਆਦਾ ਵਰਤੋਂ ਹੈ ਤਾਂ ਵੀ ਪਾਣੀ ਦੀ ਲੋੜ ਵ ਵੱਧ ਸਕਦੀ ਹੈ ਇਸ ਲਈ ਦਿਨ ਦੇ ਦੌਰਾਨ ਪਾਣੀ ਦੀ ਲੋੜ ਵਾਤਾਵਰਨ ਸਰਗਰਮੀਆਂ ਭੋਜਨ ਅਤੇ ਸਿਹਤ ਉੱਤੇ ਨਿਰਭਰ ਕਰਦੀ ਹੈ ਇਹ ਸਭ ਕਾਰਨ ਇਹ ਦੱਸਦੇ ਹਨ ਕਿ ਸਾਨੂੰ ਹਰ ਹਾਲਤ ਵਿੱਚ ਪਾਣੀ ਪੀਣ ਦੀ ਆਦਤ ਬਣਾਈ ਰੱਖਣੀ ਚਾਹੀਦੀ ਹੈ